ਤੁਸੀਂ ਬਹੁਤ ਵਧੀਆ ਡਰਾਈਵ ਕੀਤੀ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿਉਂਕਿ ਤੁਸੀਂ ਮੈਨੂੰ ਸੁਰੱਖਿਅਤ ਤਰੀਕੇ ਨਾਲ ਮੈਨੂੰ ਮੇਰੇ ਘਰ ਤੱਕ ਪਹੁੰਚਾਇਆ ਤੁਸੀਂ ਰਾਸਤੇ ਵਿੱਚ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਤੁਸੀਂ ਬੜੇ ਹੀ ਸਹੀ ਤਰੀਕੇ ਨਾਲ ਮੇਰੇ ਨਾਲ ਗੱਲਬਾਤ ਕੀਤੀ ਮੇਰਾ ਰਾਸਤੇ ਦਾ ਜੋ ਟਾਈਮ ਸੀਗਾ ਉਹ ਬੜਾ ਹੀ ਵਧੀਆ ਤਰੀਕੇ ਨਾਲ ਪਾਸ ਹੋ ਗਿਆ ਕਿਉਂਕਿ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਮੈ ਮੇਰੇ ਨਾਲ ਗੱਲਬਾਤ ਕੀਤੀ ਅਤੇ ਮੈਨੂੰ ਸਹੀ ਤਰੀਕੇ ਨਾਲ ਮੇਰੇ ਘਰ ਤੱਕ ਛੱਡ ਕੇ ਗਏ ਹੈ ਨਾ ਰਾਤ ਦਾ ਟਾਈਮ ਸੀਗਾ ਮੈਨੂੰ ਬਹੁਤ ਪ੍ਰੋਬਲਮ ਸੀਗੀ ਕਿ ਮੈਂ ਇਸ ਤਰ੍ਹਾਂ ਕਿੱਦਾਂ ਸਭ ਹੈਂਡਲ ਕਰਾਂਗੀ ਪਰ ਫਿਰ ਵੀ ਤੁਸੀਂ ਬੜੇ ਹੀ ਸਹੀ ਤਰੀਕੇ ਨਾਲ ਆਰਾਮ ਨਾਲ ਮੈਨੂੰ ਮੇਰੇ ਘਰ ਤੱਕ ਛੱਡ ਗਏ ਅਤੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਜਾਂ ਕੋਈ ਪ੍ਰੋਬਲਮ ਰਾਸਤੇ ਵਿੱਚ ਨਹੀ ਆਈ